ਟੈਕਨੋਲੋਜੀ ਨੂੰ ਸਿੱਖਣਾ ਅਤੇ ਨੌਲੇਜ ਅੱਜ ਕੱਲ੍ਹ ਦੇ ਟੈਮ ਵਿੱਚ ਸਭ ਨੂੰ ਜ਼ਰੂਰੀ ਹੈ ਕਿਉਂਕਿ ਸਾਡਾ ਬਹੁਤ ਸਾਰਾ ਜੀਵਨ ਸਾਡੇ ਰੋਜ਼ਾਨਾ ਜ਼ਰੂਰਤਾਂ ਵੀ ਬਹੁਤ ਸਾਰੀਆਂ ਲੋੜਾਂ ਸਾਡੇ ਟੈਕਨੋਲੋਜੀ ਦੇ ਅੱਜ ਕੱਲ੍ਹ ਨਿਰਭਰ ਕਰਦੀਆਂ ਹਨ ਜਿਵੇਂ ਕਿ ਮੋਬਾਇਲ ਨੂੰ ਲੈ ਲਈਏ ਮੋਬਾਇਲ ਤੋਂ ਬਿਨਾਂ ਅੱਜ ਕੱਲ੍ਹ ਮੋਬਾਇਲ ਇੰਟਰਨੈੱਟ ਤੋਂ ਬਿਨਾਂ ਜੀਵਨ ਹੀ ਅਧੂਰਾ ਲੱਗਦਾ ਹੈ ਮੋਬਾਇਲ ਕਿੰਨੇ ਜ਼ਿਆਦਾ ਫਾਇਦੇ ਹਨ ਇੰਟਰਨੈੱਟ 'ਤੇ ਅਸੀਂ ਇੱਕ ਸੈਕਿੰਡ ਵਿੱਚ ਕਿੰਨਾ ਕੁਛ ਗੂਗਲ ਰਾਹੀਂ ਲੱਭ ਲੈਂਦੇ ਹਾਂ ਕਿੰਨਾ ਕੁਛ ਲੱਭ ਲੈਂਦੇ ਹਾਂ ਇਸ ਲਈ ਦੂਜੀ ਗੱਲ ਇਹ ਵੀ ਹੈ ਜਿਹੜੀਆਂ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਹਨ ਜਿਵੇਂ ਕਿ ਫਰਿਜ਼ ਵੋਸ਼ਿੰਗ ਮਸ਼ੀਨ ਅੱਜ ਕੱਲ੍ਹ ਸਮਾਰਟ ਟੈਲੀਵਿਜ਼ਨ ਆ ਗਏ ਹਨ ਫਰਿਜ਼ ਵੀ ਅੱਜਕੱਲ੍ਹ ਵਾਈਫਾਈ ਆ ਗਏ ਹਨ ਜਿਹੜੇ ਕੱਪੜੇ ਵਾਲੀਆਂ ਮਸ਼ੀਨਾਂ ਔਟੋਮੈਟਿਕ ਹਨ ਸਾਰੀਆਂ ਵਿੱਚ ਬਹੁਤ ਸਾਰੀ ਟੈਕਨੋਲੋਜੀ ਦੀ ਵਰਤੋਂ ਹੁੰਦੀ ਹੈ ਅੱਜ ਕੱਲ੍ਹ ਆਪਾਂ ਸਾਰੇ ਕੰਮ ਮੋਬਾਇਲ 'ਤੇ ਕਰਦੇ ਹਾਂ ਜਿਵੇਂ ਆਪਾਂ ਨੂੰ ਬੈਂਕ ਜਾਣ ਦੀ ਵੀ ਲੋੜ ਨਹੀਂ ਹੈ ਆਪਾਂ ਬੈਂਕ ਆਪਾਂ ਘਰ ਬੈਠੇ ਹੀ ਸਾਰੀ ਐਫਡੀ ਦੀ ਨੌਲੇਜ ਬੈਂਕ 'ਚ ਕਿੰਨੇ ਪੈਸੇ ਹਨ ਕਿਸੇ ਨੂੰ ਆਪਾਂ ਬੈਂਕ 'ਚ ਪੈਸਾ ਭੇਜਣਾ ਹੋਵੇ ਕਿਸੇ ਅਕਾਊਂਟ 'ਚ ਪਹਿਲਾਂ ਆਪਾਂ ਨੂੰ ਬੈਂਕ ਵਿੱਚ ਜਾਣਾ ਪੈਂਦਾ ਸੀ ਅਤੇ ਆਪਾਂ ਉੱਥੇ ਜਾ ਕੇ ਘੰਟਾ ਲਾਈਨ 'ਚ ਲੱਗਦੇ ਸੀ ਤੇ ਫਿਰ ਜਾ ਕੇ ਕਿਸੇ ਨੂੰ ਪੈਸੇ ਟ੍ਰਾਂਸਫਰ ਕਰਦੇ ਸੀ ਪਹਿਲਾਂ ਆਪਾਂ ਮਨੀ ਔਰਡਰ ਕਰਦੇ ਹੁੰਦੇ ਸੀ ਅਤੇ ਉਹ 'ਚ ਵੀ ਪਹਿਲਾਂ ਮੋਬਾਇਲ ਨੂੰ ਪਹਿਲਾਂ ਆਪਾਂ ਰਿਜ਼ਲਟ ਵੀ ਦੇਖਣ ਲਈ ਕੋਲੇਜ 'ਚ ਆਪਾਂ ਸਾਰੇ ਇਕੱਠੇ ਹੁੰਦੇ ਸੀ ਅਤੇ ਉੱਥੇ ਜਾ ਕੇ ਇੱਕ ਦੂਜੇ ਲੈਮ 'ਚ ਲੱਗ ਕੇ ਆਪਾਂ ਰਿਜ਼ਲਟ ਦੇਖਦੇ ਹੁੰਦੇ ਸੀ ਅਤੇ ਇੱਕ ਦੂਜੇ ਤੋਂ ਪਤਾ ਕਰਦੇ ਤੇਰਾ ਕੀ ਰਿਜ਼ਲਟ ਆਇਆ ਕੀ ਰਿਜ਼ਲਟ ਆਇਆ ਹੁਣ ਆਪਾਂ ਮੋਬਾਇਲ 'ਤੇ ਘਰ ਬੈਠੇ ਹੀ ਔਨਲਾਈਨ ਸਭ ਦੇ ਰਿਜ਼ਲਟ ਦੇਖ ਸਕਦੇ ਹਾਂ ਕਿਤਾਬਾਂ ਵੀ ਅੱਜ ਕੱਲ੍ਹ ਸਾਰੀਆਂ ਔਨਲਾਈਨ ਮਿਲ ਜਾਂਦੀਆਂ ਹਨ ਅੱਜ ਕੱਲ੍ਹ ਸਾਰਾ ਕੁਛ ਸੌਖਾ ਹੋ ਜਾਂਦਾ ਹੈ ਯੂਟੀਊਬ 'ਤੇ ਤੁਸੀਂ ਅ ਕੋਈ ਵੀ ਐਜ਼ ਆ ਕੋਈ ਪ੍ਰੋਬਲਮ ਹੈ ਤੁਸੀਂ ਉੱਥੇ ਸਰਚ ਕਰਕੇ ਆਪਣੀ ਨੌਲੇਜ ਪ੍ਰਾਪਤ ਕਰ ਲੈਂਦੇ ਹੋ ਇਸ ਕਰਕੇ ਬੱਚੇ ਨੂੰ ਛੋਟੀ ਕਲਾਸਾਂ ਤੋਂ ਹੀ ਟੈਕਨੋਲੋਜੀ ਬਾਰੇ ਪੜ੍ਹਾਈ ਕਰਾਉਣਾ ਚਾਹੀਦਾ ਹੈ